ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਦਰਖੱਤ ਕੱਟਣੇ ਲਗਾਤਾਰ ਵੱਧ ਗਏ ਹਨ ਜਿਸ ਨਾਲ ਕੀ ਆ ਗਲੋਬਲ ਵਾਰਮਿੰਗ ਵਧਦੀ ਜਾ ਰਹੀ ਹੈ ਅਤੇ ਜਿਹੜੀ ਧਰਤੀ ਆ ਉਹ ਦਿਨ ਪਰ ਦਿਨ ਗਰਮ ਹੁੰਦੀ ਜਾ ਰਹੀ ਹੈ ਅਤੇ ਜਿਸ ਨਾਲ ਮੌਸਮ ਵਿੱਚ ਵੀ ਬਦਲਾਅ ਆਉਂਦੇ ਜਾ ਰਹੇ ਨੇ ਹੁਣ ਰੀਸੈਂਟਲੀ ਮੈਂ ਆਪਣੇ ਆਲੇ ਦੁਆਲੇ ਵੇਖਿਆ ਹੈ ਕਿ ਜੰਗਲ ਕੱਟ ਦਿੱਤੇ ਗਏ ਨੇ ਅਤੇ ਉਨ੍ਹਾਂ ਦੀ ਜਗ੍ਹਾ ਬੱਸ ਅੱਡੇ ਬਣਾ ਦਿੱਤੇ ਗਏ ਹਨ ਜਿਸ ਨਾਲ ਕੀ ਆ ਕਿ ਸਾਰਾ ਵਾਤਾਵਰਨ ਚੇਂਜ ਹੋ ਗਿਆ ਹੈ ਅਤੇ ਹਰੇਕ ਸਾਲ ਗਰਮੀ ਵਧਦੀ ਜਾ ਰਹੀ ਹੈ ਗਰਮੀ ਵਧਣ ਨਾਲ ਜਿਹੜੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਅਤੇ ਉੱਤੋਂ ਮੌਸਮ ਵੀ ਬੇਮੌਸਮੀ ਪੈ ਰਿਹਾ ਜਿਸ ਨਾਲ ਫਸਲਾਂ ਅਤੇ ਹੋਰ ਕਾਫੀ ਚੀਜ਼ਾਂ ਦਾ ਨੁਕਸਾਨ ਵੀ ਹੋਇਆ ਜਾ ਰਿਹਾ